ਸਾਡੇ ਖੇਤਰ ਵਿੱਚ ਜੋ ਡੋਕਟਰ ਹੈ ਉਹਨਾਂ ਨੂੰ ਬਹੁਤ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਪਹਿਲੀ ਗੱਲ ਤਾਂ ਇੱਥੇ ਹਸਪਤਾਲਾਂ ਵਿੱਚ ਸਮਾਨ ਹੀ ਪੂਰਾ ਉਪਲਬਧ ਨਹੀਂ ਹੁੰਦਾ ਜਿਵੇਂ ਕਿ ਟੀਕੇ ਦਵਾਈਆਂ ਅਤੇ ਹੋਰ ਬੈੱਡ ਬੈੱਡ ਦੀ ਕਮੀ ਹੋ ਜਾਂਦੀ ਹੈ ਬਾਕੀ ਹੋਰ ਜੋ ਸਮਾਨ ਹੈ ਉਹਨਾਂ ਦੀ ਵੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਕਿਆ ਹੈ ਉਹਨਾਂ ਨੂੰ ਮਨ੍ਹਾ ਕਰਨਾ ਪੈਂਦਾ ਹੈ ਮਰੀਜ਼ ਨੂੰ ਅਤੇ ਉਹਨਾਂ ਨੂੰ ਉਹਨਾਂ ਨੂੰ ਕਿਸੇ ਹੋਰ ਹੋਸਪੀਟਲ ਵਿੱਚ ਭੇਜਣ ਲਈ ਕਹਿਣਾ ਪੈਂਦਾ ਹੈ ਜਿਸ ਕਾਰਨ ਪੇਂਸ਼ੈਂਟ ਨਾਲ਼ ਵੀ ਮਾੜਾ ਹੁੰਦਾ ਹੈ ਅਤੇ ਡੋਕਟਰ ਡੋਕਟਰ ਦਾ ਵੀ ਜੋ ਆਪਣਾ ਐਕਪੀਰੀਐਂਸ ਹੈ ਉਹ ਵੀ ਜ਼ਿਆਦਾ ਯੂਜ਼ਫੁਲ ਨਹੀਂ ਹੁੰਦਾ